ਹੈਲੋ ਹਾਂਜੀ ਅ ਹਾਂਜੀ ਫਤਿਹ ਦਾ ਫ਼ਾਦਰ ਬੋਲ ਰਿਹਾ ਮੈਂ ਮੈਂ ਨਾ ਤੁਹਾਨੂੰ ਪਤਾ ਕਿਹੜੇ ਕਿਹੜੇ ਸਕੂਲ ਨੇ ਆਪਣੇ ਆਪਣੇ ਸਰਹਿੰਦ ਡਿਸਟਰਿਕਟ 'ਚ

ਅਤੇ ਤੁਹਾਡਾ ਬੱਚਾ ਕਿਹੜੇ ਸਕੂਲ 'ਚ ਪੜ੍ਹਦਾ ਜੀ ਅੱਛਾ ਲਗਾਇਆ ਹੋਇਆ ਸਕੂ ਸਕੂਲ ਦਾ ਮੀਡੀਅਮ ਕਿਹੜਾ ਹੈ ਅੱਛਾ ਮੈਂ ਨਾ ਹੁਣ ਮੇਰਾ ਬੱਚੇ ਨਾ ਚਾਰ ਕੁ ਸਾਲ ਹੋ ਗਏ ਨੇ ਸਕੂਲ 'ਚ ਪਾਦਾ ਸਕੂਲ 'ਚ ਪਾਤਾ ਅਤੇ ਤੁਸੀਂ ਤੁਸੀਂ ਕਹਿੰਦੇ ਹੋ ਮੈਂ ਕੇਂਦਰੀ ਵਿਦਿਆਲਿਆ 'ਚ ਪਾਦਾ ਉਹਨਾਂ ਨੂੰ

ਅੱਛਾ ਅਤੇ ਇਹਦੀ ਫੀਸ ਕਿੰਨੀ ਕੁ ਹੈ ਕੇਂਦਰੀ ਵਿਦਿਆਲਿਆ 'ਚ ਜੀ ਅੱਛਾ ਠੀਕ ਠੀਕ ਠੀਕ ਠੀਕ ਹੈ ਜੀ ਅਤੇ ਅਤੇ ਇੱਥੋਂ ਇਹਦਾ ਜਿਹੜਾ ਲੋਕੇਸ਼ਨ ਹੈ ਕਿੱਥੇ ਜੀ ਹੈ ਜੀ ਮੈਂ ਕਦੇ ਦੇਖਿਆ ਨਹੀਂ ਹੈ ਵੈਸੇ ਜੀ

ਮੈਨੂੰ ਦੱਸੋ ਇੱਥੋਂ ਸ ਸਰਹਿੰਦ ਤੋਂ ਕੋਲਜ 'ਚ ਜਿਹੜੀ ਸਕੂ ਅੱਛਾ ਇੱਥੇ ਕਰਿਕੁਲਾਰ ਐਕਟਿਵਿਟੀਜ਼ ਨੇ ਹੈਲੋ ਪਲੇਗਰਾਊਂਡ

ਹਾਂ ਹਾਂ ਠੀਕ ਠੀਕ ਹੈ ਮੈਮ ਠੀਕ ਠੀਕ ਠੀਕ ਹੈ ਥੈਂਕ ਯੂ ਮੈਮ ਥੈਂਕ ਥੈਂਕ ਯੂ ਜੀ